ਭਾਰਤ ਲਈ ਅਤੇ ਦੁਨੀਆ 'ਚ ਵੱਸਦੇ ਪੰਜਾਬੀਆਂ ਦੇ ਲਈ ਪੰਜਾਬ ਮੁੱਖ ਸੱਭਿਆਚਾਰਕ ਕੇਂਦਰ ਰਿਹਾ ਹੈ ਇਸ ਦੇ ਵਿੱਚ ਜੋ ਸਮੇਂ ਸਮੇਂ 'ਤੇ ਬਣਦਾ ਯੋਗਦਾਨ ਹੈ ਉਹ ਹਰੇਕ ਪੰਜਾਬੀ ਪਾਉਂਦਾ ਹੈ ਕਲਾ ਦੇ ਖੇਤਰ ਵਿੱਚ ਸੋਭਾ ਸਿੰਘ ਜੀ ਇੱਕ ਮਹਾਨ ਚਿੱਤਰਕਾਰ ਹੋਏ ਹਨ ਜਿਹਨਾਂ ਨੇ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨੂੰ ਲੋਕਾਂ ਦੇ ਸਾਹਮਣੇ ਹਰੇਕ ਵਰਕੇ ਦੇ ਉੱਤੇ ਉਲੀਕ ਕੇ ਪੇਸ਼ ਕੀਤਾ ਹੈ ਸਾਹਿਤ ਦੇ ਵਿੱਚ ਸਮੇਂ ਸਮੇਂ 'ਤੇ ਬਹੁਤ ਲੇਖਕ ਹੋਏ ਹਨ ਜਿਹਨਾਂ ਨੇ ਪੰਜਾਬੀ ਇਤਿਹਾਸ ਨੂੰ ਪ੍ਰਫੁੱਲਤ ਕਰਨ ਲਈ ਯੋਗਦਾਨ ਪਾਇਆ ਹੈ ਜਿਸ ਵਿੱਚ ਭਾਈ ਵੀਰ ਸਿੰਘ ਜੀ ਅਤੇ ਸੁਰਜੀਤ ਪਾਤਰ ਜੀ ਦਾ ਬਹੁਤ ਵੱਡਾ ਰੋਲ ਰਿਹਾ ਹੈ ਪੰਜਾਬੀ ਸੰਗੀਤ ਵਿੱਚ ਸਵਰਗੀ ਕੁਲਦੀਪ ਮਾਣਕ ਜੀ ਲਾਲ ਚੰਦ ਯਮਲਾ ਜੱਟ ਜੀ ਸੁਰਿੰਦਰ ਸ਼ਿੰਦਾ ਜੀ ਅਤੇ ਹੋਰ ਬਹੁਤ ਸਾਰੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਕਲਾਕਾਰ ਆਪਣਾ ਆਪਣਾ ਸਮੇਂ ਸਮੇਂ 'ਤੇ ਬਣਦਾ ਯੋਗਦਾਨ ਪਾਉਂਦੇ ਰਹੇ ਹਨ ਵਿਗਿਆਨ ਦੇ ਲਈ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਜਲੰਧਰ ਰੋਡ 'ਤੇ ਬਣੀ ਹੋਈ ਹੈ ਜਿਸ ਵਿੱਚ ਹਰੇਕ ਪਸ਼ੂ ਪੰਛੀ ਜੋ ਕਿ ਲੁਪਤ ਹੋ ਚੁੱਕੇ ਹਨ ਦੀ ਸੰਰਚਨਾ ਹੈ ਡਾਇਨਾਸੋਰ ਜੋ ਕਿ ਬਹੁਤ ਸਾਲ ਪਹਿਲਾਂ ਧਰਤੀ 'ਤੇ ਹੋਏ ਹਨ ਉਹਨਾਂ ਦੇ ਬਾਰੇ ਵੀ ਇਹ ਸਾਇੰਸ ਸਿਟੀ ਦੇ ਵਿੱਚ ਗਿਆਨ ਦਿੱਤਾ ਜਾਂਦਾ ਹੈ ਸਪੇਸ ਸੈਂਟਰ ਵਿੱਚ ਜਿਵੇਂ ਬੰਦਾ ਜਾਂਦਾ ਹੈ ਜਾਂ ਉੱਥੇ ਦੀ ਗਤੀਵਿਧੀਆਂ ਹਨ ਉਹਨਾਂ ਨੂੰ ਵੀ ਬਹੁਤ ਸੁਚੱਜੇ ਢੰਗ ਨਾਲ ਸਾਇੰਸ ਸਿਟੀ ਦੇ ਵਿੱਚ ਇੱਕ ਟੈਕਨਾਲੋਜੀ ਪਾਰਕ ਦੇ ਰੂਪ ਵਿੱਚ ਸਾਂਭਿਆ ਹੋਇਆ ਹੈ